ਮੈਂ ਸ਼ੂਰੂ ਤੋਂ ਗੇਮਾਂ ਖੇਡਣ ਦਾ ਬਹੁਤ ਸ਼ੌਂਕ ਹੁੰਦਾ ਸੀ ਮੈਂ ਆਪਣੇ ਫਰੈਂਡਸ ਨਾਲ ਸਕੂਲ 'ਚ ਵੀ ਬਹੁਤ ਟਾਈਮ ਜਿਹੜਾ ਉਹ ਸਪੈਂਡ ਖੇਡਦੀ ਸੀ ਕਰਦੇ ਹੁੰਦੇ ਸੀ ਖੇਡਣ ਨੂੰ ਅਤੇ ਘਰ ਆ ਕੇ ਵੀ ਮੈਂ ਆਪਣੀ ਸਹੇਲੀਆਂ ਨਾਲ ਬਹੁਤ ਖੇਡਦੀ ਹੁੰਦੀ ਸੀ ਸ਼ਾਮ ਨੂੰ ਰਲ ਮਿਲ ਕੇ ਅਸੀਂ ਖੇਡਣਾ ਪਰ ਅੱਜ ਕੱਲ੍ਹ ਦਾ ਦੇਖਿਆ ਜਾਏ ਤਾਂ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਆ ਜਾਂ ਬੱਚੇ ਹੈ ਉਹ ਸਕਰੀਨਾਂ 'ਤੇ ਫੋਨਾਂ 'ਤੇ ਜਿਹੜੀਆਂ ਗੇਮਾਂ ਖੇਡਦੇ ਰਹਿੰਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕੀ ਜਿਹੜਾ ਆਪਾਂ ਬਾਹਰ ਜਾ ਕੇ ਘਰ ਤੋਂ ਬਾਹਰ ਜਾ ਕੇ ਗੇਮਾਂ ਖੇਡੀਏ ਨਾ ਬਸ ਉਹ ਫੋਨ 'ਤੇ ਬੈਠੇ ਬੈਠੇ ਖੇਡੀ ਜਾਂਦੇ ਆ ਜਿੱਦਾਂ ਦੇ ਨਾਲ ਉਹਨਾਂ ਦੀ ਅੱਖਾਂ 'ਤੇ ਵੀ ਬਹੁਤ ਅਸਰ ਪੈਂਦਾ ਉਹਨਾਂ ਦੀ ਜਿਹੜੀ ਨਿਗਹਾ ਬਹੁਤ ਜ਼ਿਆਦਾ ਘੱਟਦੀ ਆ ਉਹਨਾਂ ਦੇ ਦਿਮਾਗ 'ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜ਼ਿਆਦਾਤਰ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਸਿਰਫ ਪੜ੍ਹਾਈ ਨੂੰ ਛੱਡ ਕੇ ਗੇਮਾਂ 'ਚ ਏ ਹੁੰਦਾ ਪੜ੍ਹਨ ਤਾਂ ਉਹਨਾਂ ਦਾ ਜਿਹੜਾ ਲੈਵਲ ਹੈ ਉਹ ਲੋਅ ਹੁੰਦਾ ਜਾਂਦਾ ਪੜ੍ਹਾਈ 'ਚ ਉਹਨਾਂ ਦਾ ਫਿਰ ਮਨ ਨਹੀਂ ਲੱਗਦਾ ਸਿਰਫ ਗੇਮਾਂ ਵਾ 'ਤੇ ਹੀ ਮਨ ਲੱਗਦਾ ਕਿ ਅਸੀਂ ਸਿਰਫ ਗੇਮ ਖੇਡਦੇ ਰਹੀਏ ਜਦੋਂ ਪ ਪੇਰੈਂਟਸ ਉਹਨਾਂ ਤੋਂ ਫੋਨ ਫੜ ਲੈਂਦੇ ਆ ਤਾਂ ਫਿਰ ਉਹਨਾਂ ਨੂੰ ਗੁੱਸਾ ਆਉਂਦਾ ਕਿ ਜਿਹੜੇ ਸਾਡੀ ਗੇਮ ਆ ਵਿੱਚ ਰਹਿ ਗਈ ਆ ਨਾ ਤੁਸੀਂ ਸਾਡੇ ਤੋਂ ਫੋਨ ਲੈ ਲਿਆ ਉਹ ਘਰਦਿਆਂ ਨਾਲ ਹੀ ਲੜਦੇ ਹੈ ਇਸ ਗੱਲ ਨੂੰ ਲੈ ਕੇ ਕਿ ਹੈ ਨਾ ਸਾਨੂੰ ਗੇਮ ਖੇਡਣ ਦਿਓ ਤਾਂ ਜਿਹੜੀ ਗੇਮ ਦੀ ਆਦਤ ਹੈ ਹੌਲੀ ਹੌਲੀ ਪੈਂਦੀ ਆ ਜਿਵੇਂ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਹੌਲੀ ਹੌਲੀ ਖੇਡਦੇ ਹਾਂ ਨਾ ਹੌਲੀ ਹੌਲੀ ਜਿਹੜੀ ਇਹਦੀ ਬਹੁਤ ਜ਼ਿਆਦਾ ਆਦਤ ਪੈ ਜਾਂਦੀ ਆ ਫਿਰ ਆਪਾਂ ਡੇਲੀ ਰੂਟੀਨ 'ਚ ਖੇਡਣਾ ਜਿਹੜੇ ਬੱਚੇ ਉਹ ਸ਼ੁਰੂ ਕਰ ਦਿੰਦੇ ਆ ਫਿਰ ਜਦੋਂ ਪੇਰੈਂਟਸ ਵੱਲੋਂ ਰੋਕਿਆ ਜਾਂਦਾ ਹੈ ਤਾਂ ਫਿਰ ਉਹ ਉਹਨਾਂ 'ਤੇ ਗੁੱਸਾ ਕਰਦੇ ਆ ਹੈ ਨਾ ਕਿ ਕਿਉਂ ਸਾਨੂੰ ਰੋਕਦੇ ਓਂ ਕਿਵੇਂ ਅਤੇ ਉਦਾਂ ਜੇ ਪੇਰੈਂਟਸ ਸ਼ੁਰੂ ਸ਼ੁਰੂਆਤ 'ਚ ਬੱਚੇ ਨੂੰ ਰੋਕਣਾ ਸ਼ੁਰੂ ਕਰ ਦੇਵੇ ਤਾਂ ਫਿਰ ਤਾਂ ਸਹੀ ਰਹਿੰਦਾ ਜੇ ਨਹੀਂ ਰੁਕਦੇ ਆ ਤਾਂ ਫਿਰ ਉਹ ਡੇਲੀ ਲਗਾਤਾਰ ਖੇਡਾਂ ਨਾਲ ਗੇਮ ਨਾਲ ਉਹਨਾਂ ਦਾ ਇੱਕ ਤਾਂ ਜਿਹੜਾ ਦਿਮਾਗ ਆ ਉਹ ਘੱਟ ਕੰਮ ਕਰੂਗਾ ਪੜ੍ਹਾਈ ਵਾਲੇ ਪਾਸੇ ਤਾਂ ਉਹਨਾਂ ਦਾ ਜਾਵੇਗਾ ਹੀ ਨਹੀਂ ਅਤੇ ਫਿਰ ਜੇ ਅੱਖਾਂ ਦੇ ਗਲ ਲਗਾ ਲਈਏ ਤਾਂ ਅੱਖਾਂ ਵੀ ਜਿਹੜੀ ਅੱਖ ਨੇ ਰੋਸ਼ਨੀ ਹੈ ਕਮਜ਼ੋਰ ਹੋਵੇਗੀ ਹੈ ਨਾ ਅਤੇ ਉਹ ਘੱਟ ਉਹਨਾਂ ਨੂੰ ਜਿਹੜੀ ਨਿਗ੍ਹਾ ਉਹਨਾਂ ਦੀ ਐਨਕਾਂ ਲੱਗ ਜਾਣਗੀਆਂ ਉਹਨਾਂ ਨੂੰ ਦਿਖਣਾ ਘੱਟ ਲੱਗੂਗਾ ਅਤੇ ਜ਼ਿਆਦਾਤਰ ਉਹਨਾਂ ਨੂੰ ਬਾਹਰ ਦੀਆਂ ਗੇਮਾਂ ਖਿਡਾਉਣੀਆਂ ਚਾਹੀਦੀਆਂ ਜਿਹਨਾ ਨਾਲ ਉਹਨਾਂ ਦੀ ਸਿਹਤ ਵੀ ਵਧੀਆ ਬਣੇ ਤੰਦਰੁਸਤ ਰਹਿਣ ਨਾ ਕੋਈ ਕਿਸੇ ਪ੍ਰਕਾਰ ਦੀ ਬਿਮਾਰੀ ਲੱਗੇ ਬਾਹਰ ਖੇਡਣ ਨਾਲ ਨਾਲੇ ਤੰਦਰੁਸਤ ਹਵਾ ਮਿਲਦੀ ਆ ਜਿੰਨਾਂ ਉਹਨਾਂ ਨੂੰ ਵਧੀਆ ਫੀਲ ਵੀ ਵਧੀਆ ਹੋਵੇਗਾ ਹੈ ਨਾ ਇੱਦਾਂ ਦੀਆਂ ਬਹੁਤ ਬਹੁਤ ਖੇਡਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਘਰ ਤੋਂ ਬਾਹਰ ਜਾ ਕੇ ਖੇਡ ਸਕਦੇ ਹਾਂ ਜਾਂ ਘਰੇ ਹੀ ਜੇ ਤੁਹਾਡੀ ਖੁੱਲੀ ਜਗ੍ਹਾ ਇਹ ਆਪਾਂ ਆਪਣੇ ਫਰੈਂਡਸ ਨੂੰ ਬੁਲਾ ਕੇ ਉਹਨਾਂ ਨਾਲ ਖੇਡ ਸਕਦੇ ਹਾਂ ਇੱਦਾਂ ਦੀਆਂ ਬਹੁਤ ਸਾਰੀਆਂ ਗੇਮਸ ਹੁੰਦੀਆਂ ਨੇ ਬਟ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਜ਼ਿਆਦਾਤਰ ਤਾਂ ਫੋਨਾਂ 'ਤੇ ਖੇਡਦੇ ਨੇ ਜਿੰਨਾਂ ਨਾਲ ਉਹਨਾਂ ਦੀਆਂ ਸਿਹਤਾਂ ਵੀ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਨੇ ਤਾਂ ਹੁਣ ਇਹ ਜ਼ਿਆਦਾਤਰ ਇਹੀ ਬੱਚਿਆਂ ਨੂੰ ਕਹਿਣਾ ਚਾਹੂੰਗੀ ਕਿ ਉਹ ਆਪਣੀਆਂ ਜਿਹੜੀਆਂ ਖੇਡਾਂ ਨੇ ਫੋਨਾਂ ਵਾਲੀਆਂ ਛੱਡ ਕੇ ਬਾਹਰ ਜਿਹੜੀਆਂ ਅਸਲੀ ਖੇਡਾਂ ਹੁੰਦੀਆਂ ਲੁੱਕਣ ਮੀਚੀ ਬਰਫ ਪਾਣੀ ਰੱਸੀ ਟੱਪਣੀ ਹੈ ਨਾ ਖੋ ਖੋ ਖੇਡਣੀ ਕਬੱਡੀ ਖੇਡਣੀ ਬੈਟ ਬੋਲ ਖੇਡਣਾ ਬਹੁਤ ਇੱਦਾਂ ਦੀਆਂ ਖੇਡਾਂ ਹੁੰਦੀਆਂ ਨੇ ਉਹ ਆਪਣੇ ਫਰੈਂਡਸ ਨਾਲ ਰਲ ਮਿਲ ਕੇ ਖੇਡਣ ਦਾ ਇੱਕ ਤਾਂ ਤੁਹਾਡੀ ਸਿਹਤ ਤੰਦਰੁਸਤ ਰਹੇਗੀ ਤੁਹਾਨੂੰ ਵਧੀਆ ਹਵ ਹਵਾ ਮਿਲਣ ਦੇ ਨਾਲ ਤੁਹਾਡੀ ਸਾਹ ਦੀ ਜਿਹੜੀ ਸਾਹ ਕਿਰਿਆ ਉਹ ਵੀ ਵਧੀਆ ਚੱਲੇਗੀ ਹੈ ਨਾ ਇੱਦਾਂ ਦੀਆਂ ਹੋਰ ਤੁਹਾਡੀਆਂ ਸਿਹਤ ਦੀਆਂ ਨਾਲ ਸੰਬੰਧਿਤ ਜਿਹੜੀਆਂ ਤੁਹਾਨੂੰ ਕੋਈ ਬਿਮਾਰੀ ਹੋਵੇਗੀ ਉਹ ਵੀ ਠੀਕ ਹੋ ਗਈ ਤੁਹਾਨੂੰ ਵਧੀਆ ਹਵਾ ਲੈਣ ਦੇ ਨਾਲ ਨਾਲ ਇੱਦਾਂ ਮੈਂ ਤਾਂ ਇਹੀ ਕਹੂੰਗੀ ਜ਼ਿਆਦਾਤਰ ਉਹ ਘਰੋਂ ਬਾਹਰ ਜਾ ਕੇ ਗੇਮ ਖੇਡਣ ਅਤੇ ਉਹਨਾਂ ਦਾ ਵਧੀਆ ਰਹੇਗਾ ਫੋਨ ਦੇ ਆਲੇ ਦੁਆਲੇ ਘੱਟ ਰਹਿਣ ਅਤੇ ਪੇਰੈਂਟਸ ਨੂੰ ਵੀ ਗੌਰ ਕਰਨੀ ਚਾਹੀਦੀ ਉਹਨਾਂ ਨੂੰ ਫੋਨ ਘੱਟ ਦੇਣਾ ਚਾਹੀਦਾ ਜਿਹਦੇ ਕਰਕੇ ਉਹਨਾਂ ਦਾ ਧ ਜਿਹੜਾ ਧਿਆਨ ਬਾਹਰ ਵਾਲੀਆਂ ਖੇਡਾਂ ਵੱਲ ਰਵੇ ਜਿਹੜੀਆਂ ਫੋਨ ਵਾਲੀਆਂ ਖੇਡਾਂ ਆ ਉਹਨਾਂ ਵੱਲ ਘੱਟ ਰਵੇ